ਭਾਰਤੀ ਸਿਹਤ ਸੰਭਾਲ ਪ੍ਰਣਾਲੀ ਹੈ ਤਾਂ ਠੀਕ ਵਧੀਆ ਹੈ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਇਲਾਜ ਹੁੰਦਾ ਹੈ ਡਾਕਟਰ ਵਧੀਆ ਹੈ ਪਰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਿਵੇਂ ਟਾਈਮ ਬਹੁਤ ਵੇਸਟ ਹੁੰਦਾ ਉੱਥੇ ਜਾ ਕੇ ਅਤੇ ਦਵਾਈਆਂ ਵੀ ਸਾਰੀਆਂ ਉੱਥੇ ਮਿਲਦੀਆਂ ਨਹੀਂ ਹੈ ਜੇ ਕੋਈ ਟੈਸਟ ਕਰਵਾਉਣਾ ਹੋਵੇ ਤਾਂ ਸਾਰਾ ਸਾਰਾ ਦਿਨ ਲੰਘ ਜਾਂਦਾ ਹੈ ਅਤੇ ਕਈ ਕਈ ਵਾਰ ਤਾਂ ਕਈ ਦਿਨ ਵੀ ਲੰਘ ਜਾਂਦੇ ਹੈ ਅਤੇ ਆਪਣੀ ਵਾਰੀ ਦੀ ਉਡੀਕ ਕਰਨੀ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਪ੍ਰਾਈਵੇਟ ਇਲਾਜ ਜੇ ਕਰਵਾਉ ਤਾਂ ਉਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹੈ ਅਤੇ ਉੱਥੇ ਪੂਰੀ ਜੇਬ ਜਿਹੜੀ ਹੈ ਖਾਲੀ ਹੋ ਜਾਂਦੀ ਹੈ ਪ੍ਰਾਈਵੇਟ ਇਲਾਜ ਕਰਵਾਉਣ ਲੱਗਿਆ ਅਤੇ ਪ੍ਰਾਈਵੇਟ ਪੂਰੀ ਲੁੱਟਾਈ ਹੁੰਦੀ ਹੈ ਡਾਕਟਰ ਪੂਰੀ ਲੁੱਟਾਈ ਕਰਦੇ ਹੈ